ਹਾਂਜੀ ਗੁਰਮੀਤ ਸਿੰਘ ਜੀ ਬੋਲ ਰਹੇ ਓਂ ਸਤਿ ਸ਼੍ਰੀ ਅਕਾਲ ਜੀ ਅਤੇ ਮੈਂ ਨਾ ਆਪਣੇ ਬੱਚੇ ਨੂੰ ਸਕੂਲ 'ਚ ਪਾਉਣਾ ਸੀ ਬੱਚੇ ਦਾ

ਹਾਂਜੀ ਹਾਂਜੀ

ਹਾਂਜੀ ਠੀਕ ਹੈ ਜੀ ਸਰਕਾਰੀ 'ਚ ਹੀ ਪਾਂਦੇ ਹਾਂ ਆਪਾਂ ਠੀਕ ਹੈ ਜੀ